ਮੇਰਾ ਨਾਮ ਸੰਜਨਾ ਹੈ ਮੈਂ ਤੁਹਾਨੂੰ ਆਪਣੇ ਪਿੰਡ ਦੇ ਪਾਣੀ ਦੀ ਘਾਟ ਬਾਰੇ ਦੱਸਣਾ ਚਾਹੁੰਦੀ ਹਾਂ ਸਾਡੇ ਪਿੰਡ ਵਿੱਚ ਕਾਫੀਆਂ ਜਗ੍ਹਾ ਖੇਤੀਬਾੜੀ ਹੁੰਦੀ ਹੈ ਜਿੱਥੇ ਕਿ ਇੱਥੇ ਨਹਿਰ ਦੀ ਕਮੀ ਵੀ ਹੈਗੀ ਹੈ ਨਹਿਰ ਵਿੱਚ ਸੁੱਕਾ ਹੁੰਦਾ ਹੈ ਉੱਥੇ ਪਾਣੀ ਵੀ ਨਹੀਂ ਆਉਂਦਾ ਹੈ ਜਿਸ ਕਾਰਨ ਖੇਤਾਂ ਵਿੱਚ ਪਾਣੀ ਨਾ ਜਾਣ ਕਾਰਨ ਖੇਤਰ ਖੇਤ ਬੰਜਰ ਹੋ ਜਾਂਦਾ ਏ ਅਤੇ ਫਸਲ ਵੀ ਚੰਗੀ ਤਰ੍ਹਾਂ ਨਹੀਂ ਹੁੰਦੀ ਏ ਲੋਕਾਂ ਦਾ ਫਸਲ ਖਰਾਬ ਹੁੰਦਾ ਹੈ ਪਾਣੀ ਨਾ ਮਿਲਣ ਕਾਰਨ ਅਤੇ ਕਈ ਵਾਰ ਘਰਦਿਆਂ ਵਿੱਚ ਵੀ ਪਾਣੀ ਦੀ ਕਮੀ ਹੋ ਜਾਂਦੀ ਜਿਸ ਕਰਕੇ ਆਪਾਂ ਪਾਣੀ ਦੀ ਨਾ ਪਾਣੀ ਨਾ ਮਿਲਣ ਕਰਕੇ ਲੋਕਾਂ ਦੇ ਟਾਈਮ ਟੂ ਟਾਈਮ ਨਾ ਪਾਣੀ ਮਿਲਦਾ ਹੈ ਉਹਨਾਂ ਦੇ ਅੰਦਰ ਦੀ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ ਪਾਣੀ ਦੀ ਕਮੀ ਨਾਲ ਕਈਆਂ ਦੀ ਪਾਣੀ ਦੀ ਕਮੀ ਨਾਲ ਕਿਡਨੀ ਖਰਾਬ ਹੋ ਜਾਂਦੀ ਆ ਇਹਨਾਂ ਦੇ ਲੋਕਾਂ ਦੀ ਹੈਲਥਾਂ ਅਤੇ ਵੀ ਕਾਫੀ ਅਸਰ ਪੈਂਦਾ ਏ ਅਤੇ ਲੋਕਾਂ ਦੀਆਂ ਫਸਲਾਂ ਅਤੇ ਖੇਤਾਂ ਅਤੇ ਹੋਰ ਪਿੰਡ ਦੀਆਂ ਮਤਲਬ ਕਿ ਸਾਰੀਆਂ ਖੇਤਾਂ ਬੰਜਰ ਵੀ ਹੋ ਜਾਂਦੀਆਂ ਹੈ ਪਾਣੀ ਟਾਈਮ 'ਤੇ ਟਾਈਮ ਤੋਂ ਨਹੀਂ ਮਿਲਣ ਕਰਕੇ ਤਾਂ ਕਿ ਸਾਨੂੰ ਇਹ ਹੈ ਕਿ ਜਿੰਨਾਂ ਤੋਂ ਜਿੰਨਾ ਵੱਧ ਤੋਂ ਵੱਧ ਰੁੱਖ ਲਗਾ ਸਕਦੇ ਹਾਂ ਲਗਾਈਏ ਅਤੇ ਸਾਨੂੰ ਮੌਸਮ ਦੇ ਹਿਸਾਬ ਨਾਲ ਕਿਤੇ ਨਾ ਕਿਤੇ ਸਾਨੂੰ ਇਕੱਠਾ ਪਾਣੀ ਇਕੱਠਾ ਕਰਨਾ ਚਾਹੀਦਾ ਤਾਂ ਕਿ ਅੱਗੇ ਸਾਨੂੰ ਖੇਤਾਂ ਵਿੱਚ ਪਾਣੀ ਮਿਲੇ ਅਤੇ ਜਿੱਥੇ ਵੀ ਮਤਲਬ ਕਈਆਂ ਇਲਾਕਿਆਂ ਵਿੱਚ ਪਾਣੀ ਦੀ ਵੀ ਕਮੀ ਹੁੰਦੀ ਹੈ